ਸਤਿ ਸ਼੍ਰੀ ਅਕਾਲ ਮੈਮ ਮੈਮ ਮੈਂ ਤੁਹਾਨੂੰ ਕਨਫਰਮ ਕਰਨ ਪੁੱਛਣਾ ਸੀਗਾ ਇੱਕ ਗੱਲ ਕਿ ਪਠਾਨਕੋਟ ਵਿੱਚ ਜ਼ਿਆਦਾ ਘੁੰਮਣ ਵਾਲੀਆਂ ਜਗ੍ਹਾ ਕਿਹੜੀਆਂ ਹੈਗੀਆਂ ਆ ਕਿਉਂਕਿ ਮੈਂ ਅੰਮ੍ਰਿਤਸਰ ਤੋਂ ਹਾਂ ਅਤੇ ਮੈਂ ਇੱਥੇ ਵਿਜ਼ਿਟ ਕੀਤਾ ਸੀਗਾ ਅਤੇ ਮੈਨੂੰ ਕੁਛ ਆਈਡੀਆ ਨਹੀਂ ਲੱਗ ਰਿਹਾ ਤਾਂ ਤੁਸੀਂ ਮੈਨੂੰ ਦੱਸੋਗੇ ਇੱਥੇ ਕੀ ਜ਼ਿਆਦਾ ਵਧੀਆ ਹੈਗਾ ਘੁੰਮਣ ਲਈ ਖਾਣ ਪੀਣ ਵਾਸਤੇ ਮੈਮ ਓਕੇ ਥੈਂਕਯੂ ਮੈਮ ਠੀਕ ਹੈ ਮੈਮ ਠੀਕ ਹੈ ਅਤੇ ਮੈਂ ਇੱਕ ਹੋਰ ਗੱਲ ਪੁੱਛਣੀ ਸੀਗੀ ਕਿ ਇਹ ਜਿਹੜੇ ਰੈਸਟੋਰੈਂਟ ਟ ਅ ਚੌਵੀ ਘੰਟੇ ਖੁੱਲ੍ਹੇ ਹੁੰਦੇ ਆ ਠੀਕ ਹੈ ਮੈਮ ਧੰਨਵਾਦ